ਮੈਨੂੰ ਚਿੱਤਰਕਾਰੀ ਕਰਨੀ ਬਹੁਤ ਪਸੰਦ ਹੈ ਇਸ ਕਰਕੇ ਮੈਂ ਚਿੱਤਰਕਾਰੀ ਕਰਨ ਲਈ ਲੋੜੀਂਦਾ ਸਮਾਨ ਆਪਣੀ ਨੇੜਲੀ ਦੁਕਾਨ ਤੋਂ ਪਹਿਲਾਂ ਖਰੀਦਦੀ ਹੁੰਦੀ ਸੀ ਪਰ ਉੱਥੇ ਕੁਛ ਸਮਾਨ ਜ਼ਿਆਦਾ ਵੀ ਨਹੀਂ ਸੀ ਅਤੇ ਰੇਟ ਵੀ ਬਹੁਤ ਜ਼ਿਆਦਾ ਮਿਲਦਾ ਹੁੰਦਾ ਸੀ ਇਸ ਕਰਕੇ ਮੈਨੂੰ ਕਿਸੇ ਨੇ ਦੱਸਿਆ ਕਿ ਹੋਲਸ ਸਾਡੇ ਨਜ਼ਦੀਕੀ ਮਾਰਕੀਟ ਇੱਕ ਹੋਰ ਹੈਗੀ ਆ ਉੱਥੇ ਹੋਲਸੇਲ ਦਾ ਸਮਾਨ ਮਿਲਦਾ ਹੈ ਫਿਰ ਮੈਂ ਉੱਥੋਂ ਟਰਾਈ ਕੀਤਾ ਉੱਥੇ ਉੱਥੋਂ ਮੈਨੂੰ ਇੱਕ ਹੀ ਦੁਕਾਨ ਵਿੱਚ ਸਾਰੀਆਂ ਚੀਜ਼ਾਂ ਵੀ ਮਿਲ ਗਈਆਂ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਬਹੁਤ ਹੀ ਅੱਛੇ ਰੇਟ ਦੇ ਵਿੱਚ ਅਤੇ ਉਹਨਾਂ ਦਾ ਮਤਲਬ ਨੇਚਰ ਵੀ ਅੱਜ ਬਹੁਤ ਅੱਛਾ ਹੈ ਕਿਉਂਕਿ ਉਹਨਾਂ ਨੇ ਆਪਣੀਆਂ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਦਿਖਾਈਆਂ ਅਤੇ ਮੈਨੂੰ ਜੋ ਜੋ ਚਾਹੀਦਾ ਸੀ ਮੈਂ ਆਪਣਾ ਲੋ ਲੋੜੀਂਦਾ ਸਮਾਨ ਇੱਕ ਹੀ ਤੋਂ ਵਧੀਆ ਤਰੀਕੇ ਨਾਲ ਅਤੇ ਘੱਟ ਸਮੇਂ ਦੇ ਵਿੱਚ ਲੈ ਲੈ ਆ ਸਕੀ ਜਿਸ ਕਰਕੇ ਮੈਨੂੰ ਪੇਂਟਿੰਗ ਕਰਨ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਇੱਕ ਟਾਈਮ 'ਤੇ ਮੈਨੂੰ ਸਾਰਾ ਸਮਾਨ ਮਿਲ ਗਿਆ ਜ਼ਿਆਦਾ ਮੈਨੂੰ ਇੱਧਰ ਉੱਧਰ ਨਹੀਂ ਫਿਰਨਾ ਪਿਆ ਕਿਉਂਕਿ ਸਾਰਾ ਸਮਾਨ ਮਿਲ ਗਿਆ